ਮੇਰੀ ਮਨਪਸੰਦ ਗੇਮ ਕ੍ਰਿਕਟ ਹੈ ਮੈਂ ਕ੍ਰਿਕਟ ਗਲੀਆਂ 'ਚ ਖੇਡਦਾ ਰਹਿੰਦਾ ਹਾਂ ਠੀਕ ਆ ਮੇਰੇ ਬਹੁਤ ਦੋਸਤ ਆ ਜੋ ਮੇਰੇ ਨਾਲ ਕ੍ਰਿਕਟ ਖੇਡਦੇ ਆ ਅਸੀਂ ਹਰ ਦਿਨ ਕ੍ਰਿਕਟ ਖੇਡਣ ਪਾਰਕ ਵਿੱਚ ਜਾਂਦੇ ਹਾਂ ਜਾਂ ਅਗਰ ਪਾਰਕ ਵਿੱਚ ਨਾ ਹੋ ਸਕੇ ਤਾਂ ਅਸੀਂ ਆਪਣੀ ਗਲੀਆਂ ਵਿੱਚ ਹੀ ਕ੍ਰਿਕਟ ਖੇਲਣਾ ਸ਼ੁਰੂ ਕਰ ਦਿੰਦੇ ਹਾਂ ਇਹਦੇ ਵਿੱਚ ਦੋ ਟੀਮਾਂ ਹੁੰਦੀਆਂ ਸੀ ਅਸੀਂ ਬਰਾਬਰ ਬਰਾਬਰ ਬੰਦੇ ਵੰਡ ਕੇ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੰਦੇ ਸੀ ਜਿਹਦੇ ਵਿੱਚ ਇੱਕ ਟੀਮ ਬੈਟਿੰਗ ਕਰਦੀ ਸੀ ਅਤੇ ਇੱਕ ਟੀਮ ਬੋਲਿੰਗ ਕਰਦੀ ਸੀ ਦੂਜੀ ਬੋਲਿੰਗ ਵਾਲੀ ਟੀਮ 'ਚ ਇੱਕ ਬੰਦਾ ਬੋਲਿੰਗ ਕਰਕੇ ਅਤੇ ਬਾਕੀ ਸਾਰੇ ਫੀਲਡਿੰਗ ਕਰਦੇ ਸੀ ਅਤੇ ਅਗਰ ਕੋਈ ਬੈਟਿੰਗ ਤੋਂ ਆਊਟ ਹੋ ਜਾਂਦਾ ਹੀ ਤਾਂ ਆਪਾਂ ਵਾਰੀਆਂ ਚੇਂਜ ਕਰਦੇ ਰਹਿੰਦੇ ਸੀਗੇ ਅਤੇ ਖੇਡ ਕੇ ਬਹੁਤ ਹੀ ਮਜ਼ਾ ਆਉਂਦਾ ਸੀ ਹਮੇਸ਼ਾ ਅਸੀਂ ਚੀਟਿੰਗਾਂ ਕਰਦੇ ਰਹਿੰਦੇ ਸੀ ਉਹ ਤੋਂ ਬਾਅਦ ਜਿਸ ਦਿਨ ਬਾਰਿਸ਼ ਹੋ ਜਾਂਦੀ ਸੀ ਜਾਂ ਅਸੀਂ ਕਿਸੀ ਕਾਰਨ ਨਹੀਂ ਖੇਡ ਪਾਉਂਦੇ ਸੀ ਅਸੀਂ ਉਹ ਤੋਂ ਬਾਅਦ ਫੋਨਾਂ 'ਤੇ ਗੇਮਾਂ ਖੇਡਣੀ ਸ਼ੁਰੂ ਕਰ ਦਿੰਦੇ ਸੀ ਸਾਡੀ ਸ਼ੁਰੂਆਤ ਲੂਡੋ ਤੋਂ ਹੋਈ ਸੀਗੀ ਅਸੀਂ ਹਮੇਸ਼ਾ ਹੀ ਲੁੂਡੋ ਖੇਡਦੇ ਰਹਿੰਦੇ ਸੀਗੇ ਉਹ ਤੋਂ ਬਾਅਦ ਕੁਝ ਸਾਲਾਂ ਬਾਅਦ ਫਿਰ ਆਪਾਂ ਫਰੀ ਫਾਈਰ 'ਤੇ ਸ਼ੁਰੂ ਹੋ ਗਏ ਫਰੀ ਫਾਈਰ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਬਹੁਤ ਹੀ ਬੋਲਦੇ ਸੀ ਅਸੀਂ ਇੱਕ ਦੂਜੇ ਨੂੰ ਤੰਗ ਕਰਦੇ ਰਹਿੰਦੇ ਸੀ ਕਿਉਂਕਿ ਉੱਥੇ ਇੱਕ ਮਾਈਕ ਦਾ ਆਪਸ਼ਨ ਸੀ ਅਸੀਂ ਹਮੇਸ਼ਾ ਹੀ ਉੱਥੇ ਖੇਡਦੇ ਰਹਿੰਦੇ ਸੀ ਉਹ ਤੋਂ ਬਾਅਦ ਅਸੀਂ ਫਿਰ ਫਿਰ ਆਪਾਂ ਆਪਣੀ ਗੇਮ ਚੇਂਜ ਕਰਕੇ ਬੀ ਜੀ ਐਮ ਆਈ ਕਰ ਲਈ ਉਹ ਤੋਂ ਬਾਅਦ ਫਿਰ ਬੀ ਜੀ ਐੱਮ ਆਈ ਬੰਦ ਹੋਣ ਤੋਂ ਬਾਅਦ ਅਸੀਂ ਫਿਰ ਵੱਖਰੀਆਂ ਵੱਖਰੀਆਂ ਗੇਮਾਂ ਖੇਡਦੇ ਰਹੇ